ਮੇਰੇ ਘਰ ਵਿੱਚ ਨਵੀਨੀਕਰਨ ਸਮੇਂ ਗਲਤੀ ਨਾਲ ਤਾਰਾਂ ਨੂੰ ਨੁਕਸਾਨ ਪਹੁੰਚ ਗਿਆ ਜਿਸ ਨਾਲ ਮੇਰੇ ਘਰ ਵਿੱਚ ਬਹੁਤ ਸਾਰੀਆਂ ਤਕਲੀਫ ਹੋਈਆਂ ਅਤੇ ਮੈਂ ਇਸ ਤਾਰਾਂ ਦੇ ਨੁਕਸਾਨ ਲਈ ਇਸ ਨੂੰ ਠੀਕ ਕਰਨ ਲਈ ਲੈਂਡਲਾਈਨ ਪ੍ਰਦਾਤਾ ਦੀ ਤਕਨੀਕੀ ਸਹਾਇਤਾ ਲਈ ਸੰਪਰਕ ਕੀਤਾ ਅਤੇ ਉਹਨਾਂ ਨੇ ਇਸ ਨੁਕਸਾਨ ਨੂੰ ਸਹੀ ਕਰਨ ਲਈ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਡੀਆਂ ਤਾ ਤਾਰਾਂ ਸਹੀ ਕਰਨ ਲਈ ਪਹੁੰਚ ਸਕਦੇ ਹਾਂ ਅਤੇ ਇਹ ਸਹਾਇਤਾ ਲੈਂਡਲਾਈਨ ਵੱਲੋਂ ਦਿੱਤੀ ਗਈ ਹੈ ਜਿਸ ਨਾਲ ਸਾਡੀਆਂ ਤਾਰਾਂ ਸੈੱਟ ਹੋ ਸਕਦੀਆਂ ਹਨ